ਹੈਲੋ ਸਤਿ ਸ਼੍ਰੀ ਅਕਾਲ ਅਤੇ ਮੈਨੂੰ ਸਰ ਆਪਣੇ ਬੱਚਿਆਂ ਲਈ ਮੈਨੂੰ ਉਹਨਾਂ ਦੇ ਵਾਤਾਵਰਨ ਪ੍ਰੋਜੈਕਟ ਲਈ ਸਮਾਨ ਚਾਹੀਦਾ ਮੈਨੂੰ ਬੱਚਿਆਂ ਦੇ ਵਾਤਾਵਰਨ ਦੇ ਪ੍ਰੋਜੈਕਟ ਲਈ ਇਹ ਜੇ ਨਕਲੀ ਜਾਨਵਰ ਚਾਹੀਦੇ ਨੇ ਅਤੇ ਆ ਗਏ ਸਾਡੇ ਨਕਲੀ ਪੇੜ ਚਾਹੀਦੇ ਨੇ ਅਤੇ ਕਲਰਫੁਲ ਪੇਜਾ ਕਲਰਫੁਲ ਪੇ ਕਲਰਫੁੱਲ ਪੇਜ ਚਾਹੀਦੇ ਨੇ ਅਤੇ ਰੰਗਾਂ ਦੀ ਡੱਬੀਆਂ ਚਾਹੀਦੀਆਂ ਹਨ ਜੀ ਮੈਨੂੰ ਬ ਬੱਚਿਆਂ ਦੇ ਵਾਤਾਵਰਨ ਲਈ ਸਬੰਧਤ ਹੈ ਸਕੂਲ ਦੇ ਵਾਤਾਵਰਨ ਤੋਂ ਸਬੰਧਤ ਹੈ ਹਾਂਜੀ ਹਾਂਜੀ ਹਾਂਜੀ ਅੱਛਾ ਮੈਨੂੰ ਇੱਦਾਂ ਕਰੋ ਦਸ ਕਲਰ ਦਸ ਤਰ੍ਹਾਂ ਦੇ ਕਲਰ ਦੇ ਪੈੱਨ ਦੇ ਦਿਓ ਗਲਿੱਟਰ ਵਾਲੇ ਹਾਂਜੀ ਅਤੇ ਇੱਕ ਹਾਂਜੀ ਹਾਂਜੀ ਕਲਰਫੁੱਲ ਡੱਬਿਆ ਦਾ ਵੀ ਇੱਕ ਸੈੱਟ ਦੇ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਚੱਲੋ ਇੱਦਾਂ ਕਰੋ ਮੈਮ ਤੁਸੀਂ ਮੈਨੂੰ ਉਹ ਵੀ ਦੇ ਦਿਓ ਫਿਰ ਡੱਬਾ ਦੇ ਦਿਓ ਬੰਡਲ ਹੀ ਦੇ ਦਿਓ ਹਾਂਜੀ ਹਾਂਜੀ ਅ ਅੱਛਾ ਜੀ ਹਾਂਜੀ ਹਾਂਜੀ ਨਹੀਂ ਮੈਮ ਇੱਦਾਂ ਸੀਗਾ ਨਾ ਜਦੋਂ ਅਸੀਂ ਤਾਂ ਮੇਰਾ ਬੱਚਾ ਹੁਣ ਸੱਤਵੀਂ ਕਲਾਸ 'ਚ ਜਦੋਂ ਚੜਿਆ ਸੀ ਨਾ ਤਾਂ ਮੈਂ ਉਹਨੂੰ ਉਦੋਂ ਸਾਰਾ ਸਮਾਨ ਲੈ ਕੇ ਦੇ ਦਿੱਤਾ ਸੀਗਾ ਹੁਣ ਜਦੋਂ ਅਗਲੀ ਜਮਾਤ ਵਿੱਚ ਚੜੂਗਾ ਨਾ ਮੈਂ ਉਸ ਟਾਈਮ ਤੁਹਾਡੀ ਦੁਕਾਨ ਤੋਂ ਉਹਨਾਂ ਨੂੰ ਬੁਲਾਵਾਂਗਾ ਹਾਂਜੀ ਠੀਕ ਹੈ ਔਰ ਮੈਮ ਇੱਦਾਂ ਕਰੋ ਤੁਸੀਂ ਨਾ ਮੈਨੂੰ ਇਹ ਵਿਜਟਿੰਗ ਕਾਰਡ ਦੇ ਦਿਓ ਅਤੇ ਮੈਂ ਫਿਰ ਆਪਣੇ ਜਿਹੜੇ ਜਾਣਕਾਰ ਹੈਗੇ ਨੇ ਉਹਨਾਂ ਨੂੰ ਦੱਸ ਦੱਸ ਦਿਆਂਗਾ ਕਿ ਜਦੋਂ ਅਸੀਂ ਨੈਕਸਟ ਟਾਈਮ ਆਵਾਂਗੇ ਫਿਰ ਉਦੋਂ ਉਹਨਾਂ ਨੂੰ ਹੋਵੇਗਾ ਵੀ ਤੁਹਾਡੇ ਕੋਲ ਕਸਟਮਰ ਆ ਜਾਣਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਮ ਤੁਸੀਂ ਮੈਨੂੰ ਦੱਸ ਡੱਬੀ ਦੇ ਦਿਓ ਫਿਰ ਤਿੰਨ ਸੌ ਰੁਪਏ ਹੋ ਗਿਆ ਉਹਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਦੇ ਦਿਓ ਓਕੇ ਓਕੇ ਮੈਮ ਉਹ ਖੁੱਲ੍ਹੇ ਤਾਂ ਨਹੀ ਮਿਲਦੇ ਹੋਣੇ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਇੱਦਾਂ ਕਰੋ ਮੈਮ ਮੈਨੂੰ ਪੰਜ ਤਰ੍ਹਾਂ ਦੇ ਜਾਨਵਰ ਦੇ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਵੀ ਪੰਜ ਮੰਨ ਲਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਮੈਮ ਹਜੇ ਤਾਂ ਬਸ ਇਹ ਹੀ ਚਾਹੀਦਾ ਸੀ ਮੈਨੂੰ ਬੱਚਿਆਂ ਦੇ ਪ੍ਰੋਜੈਕਟ ਵਾਸਤੇ ਪਰ ਜਦੋਂ ਉਹਨਾਂ ਨੂੰ ਅਗਲੀ ਵਾਰ ਕੋਈ ਹੋਰ ਪ੍ਰੋਜੈਕਟ ਮਿਲੂਗਾ ਨਾ ਤਾਂ ਉਦੋਂ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਅਤੇ ਅਸੀਂ ਮੈਮ ਸਮਾਨ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਮੈਂ ਕੋਈ ਗੱਲ ਨਹੀਂ ਜਦੋਂ ਨੈਕਸਟ ਟਾਈਮ ਸਾਨੂੰ ਲੋੜ ਪਵੇਗੀ ਠੀਕ ਹੈ ਮੈਮ ਰਾਤ ਨੌਂ ਵਜੇ ਤੋਂ ਪਹਿਲਾਂ ਠੀਕ ਹੈ ਜੀ ਹਾਂਜੀ ਧੰਨਵਾਦ ਮੈਮ ਹਾਂਜੀ ਹਾਂਜੀ ਠੀਕ ਹੈ ਮੈਮ ਓਕੇ